ਦੇਖੋ ਸਾਨੂੰ ਤਾਂ ਲੱਗਦਾ ਹੈ ਕਿ ਭਾਰਤ ਵਿੱਚ ਜਿਹੜੇ ਕਲਾਕਾਰ ਹੈਗੇ ਨੇ ਜਿਹੜਾ ਉਹਨਾਂ ਦਾ ਜਿਹੜਾ ਉਹਨਾਂ ਦਾ ਉਹਨਾਂ ਦਾ ਲੋੜੀਂਦਾ ਮਹੱਤਵ ਹੈਗਾ ਵਾ ਜਿਹੜਾ ਕਿ ਮਤਲਬ ਉਹਨਾਂ ਨੇ ਕਲਾ ਸਿੱਖੀ ਹੋਈ ਹੈ ਉਹਨਾਂ ਨੂੰ ਉਹ ਮਹੱਤਵ ਪੂਰੀ ਤਰ੍ਹਾਂ ਨਹੀਂ ਮਿਲ ਰਿਹਾ ਕਿਉਂ ਕਿਉਂਕਿ ਦੇਖੋ ਉਹਨਾਂ ਨੂੰ ਮੌਕੇ ਹੀ ਨਹੀਂ ਦਿੱਤੇ ਜਾਂਦੇ ਅੱਗੇ ਵੱਧਣ ਦੇ ਉਹਦਾ ਕਾਰਨ ਇਹ ਵਾ ਕਿ ਆਪਣਾ ਜਿੱਦਾਂ ਕਿ ਰਿਸ਼ਵਤ ਚੜ ਜਾਂਦੀ ਹੈ ਕਈ ਹਾਈ ਸੁਸਾਇਟੀ ਵਾਲੇ ਹੁੰਦੇ ਹੈ ਕਈਆਂ ਦੇ ਸਿਫਾਰਿਸ਼ਾਂ ਪੈ ਜਾਂਦੀਆਂ ਹਨ ਅਤੇ ਉਹ ਵਿਚਾਰੇ ਜਿਹੜੇ ਕਲਾਕਾਰਾਂ ਨੇ ਜਿਨ੍ਹਾਂ ਨੇ ਆਪਣੀ ਆਪਣੀ ਇੰਨੀ ਮਿਹਨਤ ਕੀਤੀ ਹੁੰਦੀ ਹੈ ਇੰਨਾ ਕਲਾ ਕਲਾ ਸਿੱਖੀ ਹੁੰਦੀ ਹੈ ਉਹ ਵਿਚਾਰੇ ਕਿ ਬੇਰੋਜ਼ਗਾਰ ਦੀ ਤਰ੍ਹਾਂ ਇੱਕ ਹਿਸਾਬ ਨਾਲ ਫਿਰਦੇ ਹਨ ਉਹਨਾਂ ਨੂੰ ਮਹੱਤਵ ਹੀ ਨਹੀਂ ਕੋਈ ਦਿੱਤਾ ਜਾਂਦਾ ਮੌਕੇ ਦੇਖੋ ਬੜੇ ਤਰ੍ਹਾਂ ਦੇ ਵੀ ਵੈਸੇ ਨਿਕਲ ਸਕਦੇ ਹਨ ਜੇ ਤਾਂ ਇਹ ਆਪਣੀ ਸਿਫਾਰਿਸ਼ਾ ਨਾ ਲਗਾਉਣ ਰਿਸ਼ਵਤ ਨਾ ਦੇਣ ਤਾਂ ਮੌਕੇ ਉਹਨਾਂ ਵਿਚਾਰਿਆਂ ਨੂੰ ਵੀ ਮਿਲਦੇ ਚਾਹੀਦੇ ਹਨ ਤਾਂ ਕਿ ਉਹ ਕਲਾ ਦਾ ਪ੍ਰਦਰਸ਼ਨ ਕਰ ਸਕਣ ਅੱਗੇ ਵੱਧ ਸਕਣ ਦੇਸ਼ ਦਾ ਭਵਿੱਖ ਉੱਜਵਲ ਕਰ ਸਕਣ ਦੇਸ਼ ਦਾ ਭਵਿੱਖ ਕਲਾਕਾਰ ਦੇਖੋ ਕਲਾਕਾਰ ਵੀ ਇੱਕ ਬਹੁਤ ਵੱਡੀ ਪੋਸਟ ਆ ਗਈ ਆ ਕਲਾ ਕਰਨਗੇ ਦੇਖੋ ਅੱਗੇ ਉਹਨਾਂ ਦੀ ਜ਼ਿੰਦਗੀ ਸਵਰੇਗੀ ਉਹਨਾਂ ਦੇ ਪਰਿਵਾਰ ਦੀ ਜ਼ਿੰਦਗੀ ਸਵਰੇਗੀ ਪਰਿਵਾਰ ਦੀ ਜ਼ਿੰਦਗੀ ਦੇਸ਼ ਦੀ ਜ਼ਿੰਦਗੀ ਸਵਰੇਗੀ ਕਲਾ ਤਾਂ ਇੱਕ ਭਗਵਾਨ ਦੀ ਦਿੱਤੀ ਹੋਈ ਕਲਾ ਹੈ ਜਿਹਨੂੰ ਕੀ ਉਹ ਪੂਰੀ ਤਰ੍ਹਾਂ ਪ੍ਰਦਰਸ਼ਨ ਕਰਦਾ ਹੈ ਅਤੇ ਉਹਨਾਂ ਨੂੰ ਲੋੜੀਂਦਾ ਮਹੱਤਵ ਹੀ ਨਹੀਂ ਦਿੱਤਾ ਜਾਂਦਾ ਲੋੜੀਂਦਾ ਮਹੱਤਵ ਦੇਣਗੇ ਤਾਂ ਮੌਕੇ ਵੱਧ ਤੋਂ ਵੱਧ ਦੇ ਵੀ ਸਕਦੀ ਹੈ ਸਰਕਾਰ